ਮੇਰੇ ਸੁਪਨੇ ਵਿੱਚ ਮੇਰੀ ਲਈਬ੍ਰੇਰੀ ਮੇਰੇ ਕਿਤਾਬਾਂ ਹਨ ਮੈਂ ਆਪਣੇ ਸੁਪਨੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਦੇਖਦੀ ਹਾਂ ਕਿਉਂਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਹੀ ਸ਼ੌਕ ਹੈ ਇਸ ਕਰਕੇ ਮੇਰੇ ਘਰ ਵਿੱਚ ਵੀ ਲਾਈਬ੍ਰੇਰੀ ਹੈ ਮੈਂ ਆਪਣੇ ਘਰ ਵਿੱਚ ਵੀ ਵੱਖਰੀ ਵੱਖਰੀ ਤਰ੍ਹਾਂ ਦੀ ਕਿਤਾਬਾਂ ਰੱਖੀਆਂ ਹੋਈਆਂ ਹਨ ਅਤੇ ਇੱਕ ਲਾਈਬ੍ਰੇਰੀ ਬਣਾਈ ਹੋਈ ਹੈ ਅਤੇ ਮੇਰੇ ਸੁਪਨਾ ਵੀ ਲਾਈਬ੍ਰੇਰੀ ਹੀ ਹੈ ਮੈਂ ਆਪਣੇ ਸੁਪਨੇ ਵਿੱਚ ਵੀ ਇੱਕ ਵੱਡੀ ਸਾਰੀ ਲਾਈਬ੍ਰੇਰੀ ਬਣਾਉਣਾ ਚਾਹੁੰਦੀ ਹਾਂ ਮੈਂ ਚਾਹੁੰਦੀ ਹਾਂ ਕਿ ਹੋਰ ਵੀ ਬੱਚੇ ਗਿਆਨ ਪ੍ਰਾਪਤ ਕਰਨ ਇਸ ਕਰਕੇ ਮੈ ਮੈਂ ਆਪਣੇ ਜੀਵਨ ਵਿੱਚ ਇੱਕ ਲਾਈਬ੍ਰੇਰੀ ਬਣਾਉਣਾ ਚਾਹੁੰਦੀ ਹਾਂ ਕਿ ਮੈਂ ਬਾਕੀਆਂ ਨੂੰ ਵੀ ਗਿਆਨ ਦੇ ਸਕਾਂ ਧੰਨਵਾਦ